ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕੀ ਹਾਲ ਚਾਲ ਨੇ ਤੁਸੀਂ ਭਾਅ ਜੀ ਸਾਹਿਬ ਢਾਬੇ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਢਾਬੇ ਦਾ ਨਾਮ ਬਹੁਤ ਸੁਣਿਆ ਹੋਇਆ ਹੈ ਮੇਰੇ ਦੋਸਤ ਨੇ ਦੱਸਿਆ ਸੀ ਕਿ ਤੁਸੀਂ ਬਹੁਤ ਵਧੀਆ ਖਾਣਾ ਬਣਾਉਂਦੇ ਹੋ ਮੈਂ ਉਹਨਾਂ ਨੇ ਦੱਸਿਆ ਸੀ ਕਿ ਤੁਸੀਂ ਸਾਗ ਬਹੁਤ ਵਧੀਆ ਬਣਾਉਂਦੇ ਹੋ ਅਤੇ ਨਾਲ ਮੱਕੀ ਦੀ ਰੋਟੀ ਅਤੇ ਮੱਖਣ ਵੀ ਬਹੁਤ ਵਧੀਆ ਹੁੰਦਾ ਹੈ ਇਸ ਤੋਂ ਇਲਾਵਾ ਮੈਂ ਸੁਣਿਆ ਸੀ ਕਿ ਤੁਸੀਂ ਪਾਲਕ ਪਨੀਰ ਮਟਰ ਪਨੀਰ ਵਗੈਰਾ ਵੀ ਬਹੁਤ ਵਧੀਆ ਬਣਾਉਂਦੇ ਹੋ ਇਸ ਤੋਂ ਇਲਾਵਾ ਭਾਅ ਜੀ ਮੈਂ ਤੁਹਾਤੋਂ ਇਹ ਪੁੱਛਣਾ ਚੀ ਸੀ ਕਿ ਤੁਸੀਂ ਮਿੱਠੇ ਵਿੱਚ ਕੀ ਰੱਖਿਆ ਹੋਇਆ ਹੈ ਇੱਥੇ ਜਿਵੇਂ ਕਿ ਸੇਮ ਜਿਵੇਂ ਕਿ ਸੇਮ ਭਾਅ ਜੀ ਆਈਸ ਕ੍ਰੀਮ ਜਲੇਬੀਆਂ ਵਗੈਰਾ ਵੀ ਤੁਹਾਡੇ ਕੋਲ ਮਿੱਠੇ 'ਚ ਹੈਗੇ ਹੈ ਮੈਂ ਭਾਅ ਜੀ ਜਦੋਂ ਵੀ ਤੁਹਾਡੇ ਢਾਬੇ ਦੇ ਵੱਲ ਨੂੰ ਆਉਂਗੀ ਤਾਂ ਖਾਣਾ ਖਾ ਕੇ ਜ਼ਰੂਰ ਇੱਥੋਂ ਜਾਉਂ ਧੰਨਵਾਦ ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੱਸਣ ਵਾਸਤੇ